ਰੂਪਨਗਰ ਜ਼ਿਲ੍ਹੇ ਵਿੱਚ ਸਥਾਨਕ ਸਥਾਨਕ ਸਰਕਾਰਾਂ ਅਤੇ ਰਾਜਨੀਤਿਕ ਢਾਂਚੇ ਦੇ ਵਿੱਚ ਬਹੁਤ ਬਹੁਤ ਹੀ ਦਲ ਹਨ ਜਿਵੇਂ ਕਿ ਕਾਂਗਰਸ ਸ਼੍ਰੋਮਣੀ ਅਕਾਲੀ ਅਤੇ ਆਮ ਆਦਮੀ ਪਾਰਟੀ ਪਿਛਲੇ ਕਈ ਸਾਲਾਂ ਤੋਂ ਇਹ ਦਲ ਬਦਲਦੇ ਆ ਰਹੇ ਹਨ ਇਸ ਵਾਰ ਆਮ ਆਦਮੀ ਪਾਰਟੀ ਵਜੋਂ ਐਡਵੋਕੇਟ ਦਿਨੇਸ਼ ਚੱਡਾ ਨੂੰ ਐੱਮ ਐੱਲ ਏ ਨਿਯੁਕਤ ਕੀਤਾ ਗਿਆ ਹੈ ਅਤੇ ਰੋਪੜ ਦੇ ਪੁਰਾਣੇ ਵਿਧਾਇਕ ਦਾ ਨਾਮ ਡਾਕਟਰ ਦਲਜੀਤ ਸਿੰਘ ਚੀਮਾ ਸੀ ਜਿਨ੍ਹਾਂ ਨੇ ਰੂਪਨਗਰ ਦੀ ਪ੍ਰਗਤੀ ਅਤੇ ਡਿਵੈਲਪਮੈਂਟ ਲਈ ਬਹੁਤ ਕਾਰਜ ਕੀਤੇ ਹਾਲ ਹੀ ਵਿੱਚ ਦਿਨੇਸ਼ ਚੱਡਾ ਜੀ ਨੇ ਤਹਿਸੀਲ ਵਿੱਚ ਛਾਪਾ ਮਾਰ ਕੇ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਕਦਮ ਉਠਾਇਆ ਹੈ ਜੋ ਕਿ ਬਹੁਤ ਸਹਾਰਨਯੋਗ ਹੈ